ਪੰਦਰਾਂ ਮਾਰਚ ਉੱਨੀ ਸੌ ਚੌਂਹਠ ਇੱਕੀ ਮਾਰਚ ਉੱਨੀ ਸੌ ਸਤਾਸੀ ਪੱਚੀ ਦਸੰਬਰ ਉੱਨੀ ਸੌ ਬਾਨਵੇਂ ਸਤਾਰ੍ਹਾਂ ਜਨਵਰੀ ਉੱਨੀ ਸੌ ਇਕਿਆਸੀ ਅਠਾਈ ਨਵੰਬਰ ਦੋ ਹਜ਼ਾਰ ਸੌਲ੍ਹਾਂ